ਭਾਰਤ ਵਿੱਚ ਬਹੁਤ ਜ਼ਿਆਦਾ ਤਰੱਕੀ ਹੋਈ ਹੈ ਉਦਯੋਗਪਤੀਆਂ ਅਤੇ ਨੇਤਾ ਇਹਨਾਂ ਦਾ ਤਰੱਕੀ ਦੌਰਾਨ ਨਵੇਂ ਤਰੀਕਿਆਂ ਨਾਲ ਬਦਲਿਆ ਜਿਵੇਂ ਫੋਨ ਤਕਨਾਲੋਜੀ ਕਾਰਨ ਅੰਬਾਨੀ ਦੇ ਫੋਨ ਦੇ ਮਨੋਰੰਜਨਾ ਅਤੇ ਸਾਧਨ ਵਧੇ ਹੈ ਅਤੇ ਆਵਾਜਾਈ ਦੇ ਉਹਨਾਂ ਵਿੱਚੋਂ ਫੋਨ ਰਾਹੀਂ ਲੋਕਾਂ ਨੂੰ ਪੈਸੇ ਦਾ ਲੈਣ ਦੇਣ ਕਰਨਾ ਬਹੁਤ ਸੌਖਾ ਹੋ ਗਿਆ ਜੋ ਕਿ ਬੈਂਕਾਂ ਵਿੱਚ ਲਾਈਨਾਂ ਵਿੱਚ ਲੱਗਣ ਦੀ ਬਜਾਏ ਹਰੇਕ ਇਨਸਾਨ ਦੇ ਫੋਨ ਵਿੱਚ ਮੰਨ ਲਓ ਐਪ ਚੱਲਦੀ ਹੈ ਪੇਟੀਐਮ ਚੱਲਦਾ ਗੂਗਲ ਪੇਅ ਚੱਲਦਾ ਜਿਸ ਨਾਲ ਲੋਕ ਪੈਸੇ ਦਾ ਲੈਣ ਦੇਣ ਆਸਾਨੀ ਨਾਲ ਕਰ ਲੈਂਦੇ ਹੈ ਮਨੋਰੰਜਨ ਦੇ ਸਾਧਨ ਵੀ ਅੱਗੇ ਲੋਕਾਂ ਨੂੰ ਸਿਨੇਮਿਆਂ ਪਾਰਕਾਂ 'ਚ ਜਾਣਾ ਪੈਂਦਾ ਸੀ ਹੁਣ ਘਰ ਬੈਠੇ ਸੋਸ਼ਲ ਮੀਡੀਆ ਰਾਹੀਂ ਤਕਨੀਕ ਦੇ ਕਾਰਨ ਹੀ ਹਰੇਕ ਸਰਕਾਰ ਦੀ ਖਬਰ ਲੋਕਾਂ ਤੱਕ ਸਮੇਂ ਸਿਰ ਪਹੁੰਚ ਜਾਂਦੀ ਹੈ ਜੇ ਟਰੇਨ ਜਾਂ ਹਵਾਈ ਟਿਕਟਾਂ ਬੁੱਕ ਕਰਾਉਣੀਆਂ ਹੋਣ ਉਹ ਵੀ ਲੋਕ ਘਰ ਬੈਠੇ ਹੀ ਕਰਾ ਲੈਂਦੇ ਹੈ ਆਸਾਨੀ ਨਾਲ ਸ਼ੋ ਫੋਨ ਦੀ ਤਕਨੀਕ ਰਾਹੀਂ ਲੋਕਾਂ ਨੂੰ ਬਹੁਤ ਸਮੇਂ ਦਾ ਬਹੁਤ ਉੱਥੇ ਹਰਾਸਮੈਂਟ ਤੋਂ ਬਚਾਅ ਰਹਿੰਦਾ ਜੋ ਕਿ ਸਾਰੇ ਕੰਮ ਆਪਣੇ ਘਰ ਬੈਠੇ ਹੀ ਕਰ ਲੈਂਦੇ ਹਨ ਜਾਣ ਆਉਣ ਦੀ ਤਕਲੀਫ ਬਹੁਤ ਘੱਟ ਕਰਨੀ ਪੈਂਦੀ ਹੈ ਅਤੇ ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਤਰੱਕੀ ਵੱਲ ਜਾ ਰਿਹਾ ਹੈ ਬਹੁਤ ਨੇਤਾ ਅਤੇ ਤਕਨਾਲੋਜੀ ਉਦਯੋਗਪਤੀਆਂ ਦਾ ਇਸ ਵਿੱਚ ਹੱਥ ਹੈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ